ਭੰਗੜਾ ਐਰੋਬਿਕਸ ਇਕ ਕਸਰਤ ਹੁੰਦੀ ਹੈ ਜਿਸ ਵਿੱਚ ਬਹੁਤ ਹੀ ਜ਼ਿਆਦਾ ਊਰਜਾ ਦੀ ਜ਼ਰੂਰਤ ਹੁੰਦੀ ਹੈ ਆਰੋਬਿਕਸ ਦਾ ਮਤਲਬ ਹੁੰਦਾ ਹੈ ਕੋਈ ਵੀ ਕੰਮ ਜਿਸ ਨੂੰ ਕਰਨ ਲਈ ਸਾਨੂੰ ਆਕਸੀਜਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਸਾਇਕਲਿੰਗ ਤੈਰਾਕੀ ਅਤੇ ਹੋਰ ਵੀ ਭੰਗੜਾ ਜਿਵੇਂ ਕਿ ਪੰਜਾਬ ਦਾ ਲੋਕ ਨਾਚ ਹੈ ਅਤੇ ਭੰਗੜਾ ਐਰੋਬਿਕਸ ਇੱਕ ਤਰ੍ਹਾਂ ਦੀ ਕਸਰਤ ਹੁੰਦੀ ਹੈ ਮੈ ਮੈਂਨੂੰ ਜਿਵੇਂ ਕਿ ਪਹਿਲਾਂ ਤੋਂ ਹੀ ਡਾਂਸ ਦਾ ਬਹੁਤ ਸ਼ੌਕ ਸੀ ਤਾਂ ਮੈਂ ਇਸ ਬਾਰੇ ਪਹਿਲਾਂ ਆਪਣੇ ਦੋਸਤਾਂ ਤੋਂ ਸੁਣਿਆ ਹੋਇਆ ਸੀ ਕਿ ਭੰਗੜਾ ਐਰੋਬਿਕਸ ਨਾਂ ਦੀ ਕੋਈ ਚੀਜ਼ ਹੁੰਦੀ ਹੈ ਬਟ ਮੈਨੂੰ ਇਹਦੇ ਬਾਰੇ ਜ਼ਿਆਦਾ ਕੁਛ ਪਤਾ ਨਹੀਂ ਸੀ ਮੈਨੂੰ ਇਸ ਬਾਰੇ ਪੂਰੀ ਤਰ੍ਹਾਂ ਉਦੋਂ ਜਾਣਕਾਰੀ ਮਿਲੀ ਜਦੋਂ ਮੈਨੂੰ ਕਰੋਨਾ ਦੇ ਵਿੱਚ ਮੋਟਾਪਾ ਹੋਇਆ ਜਦੋਂ ਮੈਂ ਮੋਟਾਪੇ ਦਾ ਸ਼ਿਕਾਰ ਹੋਈ ਉਦੋਂ ਮੈਂ ਯੂਟੀਊਬ 'ਤੇ ਭੰਗੜਾ ਐਰੋਬਿਕਸ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਭੰਗੜਾ ਐਰੋਬਿਕਸ ਕਰਨ ਨਾਲ ਸਾਡਾ ਮੋਟਾਪਾ ਘਟਦਾ ਹੈ ਸਾਡੇ ਚਰਬੀ ਪੰਜ ਸੋ ਤੋਂ ਅੱਠ ਸੌ ਕੈਲੋਰੀਜ ਤੱਕ ਖਤਮ ਹੁੰਦੀ ਹੈ ਨਸ਼ਟ ਹੁੰਦੀ ਹੈ ਭੰਗੜਾ ਐਰੋਬਿਕਸ ਕਰਨ ਨਾਲ ਇਨਸਾਨ ਦਾ ਬਾਹਾਂ ਦਾ ਮੋਟਾਪਾ ਢਿੱਡ ਦਾ ਮੋਟਾਪਾ ਅਤੇ ਪੂਰੇ ਸਰੀਰ ਦਾ ਵਜ਼ਨ ਵੀ ਘਟਦਾ ਹੈ ਇਸ ਨੂੰ ਕਰਨ ਨਾਲ ਸਾਡੇ ਸਰੀਰ ਸਵੱਸਥ ਰਹਿੰਦਾ ਹੈ ਅਤੇ ਸਾਡੀ ਮਾਨਸਿਕ ਸਿਹਤ ਵੀ ਸਵੱਸਥ ਰਹਿੰਦੀ ਹੈ ਸਾਡੇ ਅੰਦਰ ਊਰਜਾ ਆਉਂਦੀ ਹੈ ਕਿਉਂਕਿ ਇਹ ਇੱਕ ਐਰੋਬਿਕਸ ਹੈ ਇਸ ਲਈ ਇਸ ਨੂੰ ਕਰਨ ਲਈ ਊਰਜਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਤੇ ਇਸ ਨਾਲ ਕਾਫ਼ੀ ਸ਼ਕਤੀ ਵੀ ਮਹਿਸੂਸ ਹੁੰਦੀ ਹੈ ਭੰਗੜਾ ਐਰੋਬਿਕਸ ਕਰਨ ਨਾਲ ਮੈਨੂੰ ਬਹੁਤ ਹੀ ਫ਼ਰਕ ਮਹਿਸੂਸ ਹੋਇਆ ਮੇਰਾ ਕਾਫ਼ੀ ਵੇਟ ਘੱਟ ਵੀ ਗਿਆ ਅਤੇ ਇਸਨੂੰ ਕਰਨ ਤੋਂ ਬਾਅਦ ਮੇਰੇ ਅੰਦਰ ਇੱਕ ਨਵੀਂ ਊਰਜਾ ਇੱਕ ਨਵਾਂ ਜੋਸ਼ ਜਾਗ ਗਿਆ ਸੀ ਧੰਨਵਾਦ